ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਠਾਨਕੋਟ ਤੋਂ ਹਰਜੀਤ ਕੋਰ ਬੋਲ ਰਹੀ ਹਾਂ ਜਿਵੇਂ ਕਿ ਸਾਡੇ ਖੇਤਰ ਦੇ ਕਾਫ਼ੀ ਲੋਕ ਗੀਤ ਮਸ਼ਹੂਰ ਹਨ ਜਿਵੇਂ ਕਿ ਸਾਡੇ ਮਸ਼ਹੂਰ ਗਾਇਕਾ ਸੁਰਿੰਦਰ ਕੌਰ ਪ੍ਰਕਾਸ਼ ਕੌਰ ਇਹਨਾਂ ਦੇ ਲੋਕ ਗੀਤ ਕਾਫ਼ੀ ਮਸ਼ਹੂਰ ਹਨ ਜਿਵੇਂ ਕਿ ਇਹ ਵੀ ਲੋਕ ਗੀਤ ਜੋ ਹੈ ਵਿਆਹ ਸਮੇਂ ਗਾਏ ਜਾਂਦੇ ਹਨ ਕੁੜੀ ਦੀ ਵਿਦਾਈ ਸਮੇਂ ਗਾਏ ਜਾਂਦੇ ਨੇ ਅਤੇ ਕੁੜੀ ਦੇ ਵਿਆਹ ਜਦੋਂ ਕੁੜੀਆਂ ਇਕੱਠੀਆਂ ਹੁੰਦੀਆਂ ਹਨ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ ਤੋ ਤਾਂ ਵੀ ਇਹ ਗੀਤ ਗਾਏ ਜਾਂਦੇ ਹਨ ਜਿਵੇਂ ਕਿ ਮੇਲਿਆਂ ਦੇ ਵਿੱਚ ਵੀ ਇਹ ਗੀਤ ਗਾਏ ਜਾਂਦੇ ਹਨ ਕਾਫ਼ੀ ਮਤਲਬ ਕਿ ਸਾਡੇ ਲੋਕ ਗੀਤ ਖੇਤਰ ਦੇ ਮਸ਼ਹੂਰ ਹਨ ਜਿਵੇਂ ਕਿ ਮਾਵਾਂ ਅਤੇ ਧੀਆਂ ਇਹ ਲੋਕ ਗੀਤ ਕਾਫ਼ੀ ਮਸ਼ਹੂਰ ਹੈ ਜੋ ਕਿ ਮਾਵਾਂ ਧੀਆਂ ਇਕੱਠੀਆਂ ਬੈਠ ਕੇ ਬੈਠਦੀਆਂ ਹਨ ਅਤੇ ਉਹਨਾਂ 'ਤੇ ਲੋਕ ਲੋਕ ਗੀਤ ਲੋਕ ਗੀਤ ਅਧਾਰਿਤ ਹੈ ਜਿਵੇਂ ਕਿ ਇੱਕ ਧੀ ਨੂੰ ਜਿਸ ਤਰ੍ਹਾਂ ਕਿ ਮ ਹਿਮਾਚਲ ਪਹਾੜਾਂ ਵੱਲ ਵਿਆਹ ਦਿੰਦੇ ਆ ਉਹ ਗੀਤ ਮਸ਼ਹੂਰ ਹੈ ਕਿ ਬਾਕੀ ਤੇ ਦਿੱਤੀਆਂ ਮਾਝੇ ਤੇ ਦੁਆਬੜੇ ਮੈਨੂੰ ਕੀ ਦਿੱਤਾ ਪਹਾੜਾਂ ਵੱਲ ਤੋਰ ਵੇ ਇਸ ਤਰ੍ਹਾਂ ਦੇ ਕਾਫ਼ੀ ਲੋਕ ਗੀਤ ਗਾਏ ਜਾਂਦੇ ਹਨ ਜਿਵੇਂ ਕਿ ਲੋਕ ਜ ਜਿਸ ਤਰ੍ਹਾਂ ਕੁੜੀ ਦੀ ਵਿਦਾਈ ਦੇ ਸਮੇਂ ਵੀ ਜੋ ਲੋਕ ਗੀਤ ਗਾਇਆ ਜਾਂਦਾ ਹੈ ਉਹ ਕਾਫ਼ੀ ਮਤਲਬ ਚਰਚਿਤ ਲੋਕ ਗੀਤ ਹੈ ਇਹ ਸਾਰੇ ਹੀ ਜਿਵੇਂ ਸਾਡੇ ਪੰਜਾਬੀ ਗਾਇਕ ਸੁਰਿੰਦਰ ਕੌਰ ਪ੍ਰਕਾਸ਼ ਕੌਰ ਅਤੇ ਨਰਿੰਦਰ ਬੀਬਾ ਇਹਨਾਂ ਦੇ ਲਿਖੇ ਹੋਏ ਕਾਫ਼ੀ ਗੀਤ ਹਨ